ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਦੀਆ ਸ਼ਰਮਾ ਹੈ ਕੁਝ ਦਿਨਾਂ ਪਹਿਲਾਂ ਮੈਂ ਤੁਹਾਡੀ ਕੰਪਨੀ ਤੋਂ ਇੱਕ ਲੈਪਟੋਪ ਔਡਰ ਕੀਤਾ ਸੀ ਅਤੇ ਜਿਵੇਂ ਕਿ ਤੁਸੀਂ ਦੱਸਿਆ ਸੀ ਕਿ ਤੁਹਾਡਾ ਖੁਦ ਦੇ ਕੰਪਨੀ ਦਾ ਇੰਪਲੋਈ ਹੀ ਹੋਮ ਡਿਲੀਵਰੀ ਕਰਕੇ ਜਾਣਗੇ ਤਾਂ ਮੈਨੂੰ ਉਸ ਤਰ੍ਹਾਂ ਹੀ ਹੋਮ ਡਿਲੀਵਰ ਹੋਇਆ ਏ ਲੈਪਟੋਪ ਅਤੇ ਜਿਵੇਂ ਜਿਵੇਂ ਤੁਸੀਂ ਮੈਨੂੰ ਐਕਸਪਲੇਨ ਕਰਿਆ ਸੀ ਵੀ ਵਿੰਡੋਜ਼ ਕਿਵੇਂ ਹੋਣਗੀਆਂ ਉਹ ਸੇਮ ਉੱਦਾਂ ਹੀ ਹਨ ਸਕਰੀਨ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਸਮੂਦ ਹੈ ਅੱਖਾਂ 'ਤੇ ਇਹ ਘੱਟ ਬਹੁਤ ਹੀ ਘੱਟ ਇਫੈਕਟ ਪੈਂਦਾ ਬਾਕੀ ਫੀਚਰ ਜਿਵੇਂ ਤੁਸੀਂ ਮੈਨੂੰ ਸਮਝਾਏ ਸੀ ਡਿਊਰਿੰਗ ਦਾ ਪ੍ਰਚੇਜ਼ ਉਹ ਬਿਲਕੁਲ ਉੱਦਾਂ ਹੀ ਹਨ ਅਤੇ ਪ੍ਰਾਈਜ਼ ਵੀ ਬਿਲਕੁਲ ਸਹੀ ਹੈ ਜਦੋਂ ਮੈਂ ਕਾਲਜ ਲੈ ਕੇ ਗਈ ਆਪਣਾ ਲੈਪਟੋਪ ਤਾਂ ਮੇਰੇ ਉੱਥੇ ਫਰੈਂਡਸ ਨੇ ਵੇਖਿਆ ਤਾਂ ਉਹਨਾਂ ਨੂੰ ਵੀ ਇਹ ਬਹੁਤ ਪਸੰਦ ਆਇਆ ਅਤੇ ਉਹਨਾਂ ਨੂੰ ਫਿਰ ਮੈਂ ਉਹਨਾਂ ਨੇ ਜਦੋਂ ਆਪਣਾ ਇੰਟਰਸਟ ਦਿਖਾਇਆ ਖਰੀਦਣ 'ਚ ਤਾਂ ਮੈਂ ਉਹਨਾਂ ਨਾਲ ਤੁਹਾਡੀ ਵੈਬਸਾਈਟ ਸ਼ੇਅਰ ਕੀਤੀ ਤਾਂ ਮੈਂ ਐਕਸਪੈਕਟ ਕਰ ਰਹੀ ਹਾਂ ਕਿ ਮੇਰੇ ਫਰੈਂਡਸ ਵੀ ਹਨ ਜੋ ਔਡਰ ਕਰਨਗੇ ਤੁਹਾਡੇ ਕੰਪਨੀ 'ਚੋਂ ਲੈਪਟੋਪ ਅਤੇ ਮੈਂ ਤੁਹਾਡੀ ਬਹੁਤ ਹੀ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਕ ਸਟੀਕ ਰੇਟ 'ਤੇ ਲੈਪਟੋਪ ਵੇਚਿਆ ਅਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਹੋਰ ਮੇਰੇ ਫੈਮਿਲੀ ਅਤੇ ਫਰੈਂਡਸ ਉਹਨਾਂ ਨਾਲ ਵੀ ਇੱਦਾਂ ਹੀ ਸਹੀ ਰੇਟ 'ਤੇ ਬਿਲਕੁਲ ਵੇਚੋਗੇ ਅਤੇ ਬਾਕੀ ਓਵਰਆਲ ਡਿਲੀਵਰੀ ਅਤੇ ਫੀਚਰਸ ਲਈ ਬਹੁਤ ਬਹੁਤ ਅ ਵਧੀਆ ਲੈਪਟੋਪ ਹੈ ਬਹੁਤ ਹੀ ਅੱਛਾ ਮੋਡਲ ਹੈ ਧੰਨਵਾਦ